ਈਕਮਰਸ ਐਪ ਸਾਡੀ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਇੱਕ ਐਪਸ ਬਣ ਕੇ ਆ ਰਹੀਆਂ ਹਨ ਜਿਵੇਂ ਕਿ ਅਸੀਂ ਕੋਈ ਵੀ ਸੇਲ ਕਰਨਾ ਹੋਵੇ ਪਰਚੇਜ ਕਰਨਾ ਹੋਵੇ ਅਸੀਂ ਕੋਈ ਵੀ ਸਮਾਨ ਲੈਣਾ ਹੋਵੇ ਅਸੀਂ ਈਕਮਰਸ ਐਪ 'ਤੇ ਓਹਨਾਂ ਨੂੰ ਅੱਛੀ ਤਰ੍ਹਾਂ ਅਤੇ ਵਧੀਆ ਤਰੀਕੇ ਨਾਲ ਅਸੀਂ ਮੰਗਵਾ ਸਕਦੇ ਹਾਂ ਘਰ ਬੈਠੇ ਸਾਰਾ ਸਮਾਨ ਮੰਗਵਾ ਸਕਦੇ ਹਾਂ ਇਸ ਵੀ ਸਾਨੂੰ ਸਭ ਤੋਂ ਬੜੀ ਸਹੂਲਤ ਹੈ ਕਿ ਸਾਨੂੰ ਘਰ ਤੋਂ ਬਾਹਰ ਨਹੀਂ ਜਾਣਾ ਪੈਂਦਾ ਸਾਡੇ ਘਰ ਵਿੱਚ ਡਿਲੀਵਰੀ ਬੁਆਏ ਆ ਕੇ ਸਾਨੂੰ ਜਿਨ ਜਿਹੜਾ ਵੀ ਸਮਾਨ ਹੈ ਅਤੇ ਸਾਡੀ ਮਨਪਸੰਦ ਸਮਾਨ ਸਾਨੂੰ ਘਰ ਪਹੁੰਚਾ ਦਿੰਦਾ ਹੈ ਜਿਸ ਨਾਲ ਹੈ ਕਿ ਸਾਨੂੰ ਵਧੀਆ ਕੁਆਲਟੀ ਸਮਾਨ ਮਿਲਦਾ ਹੈ ਆਪਣਾ ਮਨਪਸੰਦ ਸਮਾਨ ਮਿਲਦਾ ਹੈ ਅਤੇ ਅਸੀਂ ਅਸੀਂ ਉਸ ਸਮਾਨ ਨੂੰ ਅੱਛੀ ਤਰ੍ਹਾਂ ਯੂਜ ਕਰਕੇ ਠੀਕ ਹੈ ਜੇ ਸਾਨੂੰ ਨਹੀਂ ਪਸੰਦ ਆਉਂਦਾ ਅਸੀਂ ਉਸਨੂੰ ਫਿਰ ਦੁਬਾਰਾ ਵਾਪਿਸ ਕਰ ਸਕਦੇ ਹਨ ਅਤੇ ਰਿਟਰਨ ਕਰ ਸਕਦੇ ਹਾਂ ਜੇ ਸਾਨੂੰ ਸਮਾਨ ਨਹੀਂ ਚਾਹੀਦਾ ਸਾਨੂੰ ਉਸਦੇ ਪੈਸੇ ਵਾਪਸ ਪੂਰੇ ਮਿਲਜੂੰਗੇ ਇਸ ਲਈ ਈ ਜੋ ਈਕਮਰਸ ਐਪ ਹੈ ਸਾਡੇ ਬਹੁਤ ਹੀ ਵ ਸਾਨੂੰ ਵਧੀਆ ਤਰੀਕੇ ਨਾਲ ਇੱਕ ਪਲੇਟਫਾਰਮ ਜਾਰੀ ਕਰਦੀ ਹੈ ਸਮਾਨ ਲੈਣ ਅਤੇ ਦੇਣ ਦਾ ਇਸ ਲਈ ਈਕਮਰਸ ਐਪ ਵੱਧ ਤੋਂ ਵੱਧ ਯੂਜ ਕਰੋ ਜਿਸ ਨਾਲ ਕਿ ਸਾਨੂੰ ਵ ਵਧੀਆ ਸਮਾਨ ਮਿਲ ਸਕੇ ਇੱਕ ਤਾਂ ਇਸ ਵਿੱਚ ਸੇਲ ਜਿਵੇਂ ਕਿ ਫੈਸਟੀਵਲ ਹੋ ਗਏ ਖੁਸ਼ੀ ਦੇ ਮੌਕੇ ਹੋ ਗਏ ਇਸ ਵਿੱਚ ਸੇਲ ਬਹੁਤ ਵਧੀਆ ਡਿਸਕਾਊਂਟ 'ਤੇ ਲੱਗਦੀ ਹੈ ਅਤੇ ਅਸੀਂ ਇਸ ਨਾਲ ਹੋਰ ਹੋਰ ਵਧੀਆ ਸੇ ਸੇ ਜ਼ਿਆਦਾ ਸੇਲ ਆਉਂਦੀ ਹੈ ਤਾਂ ਸਾਨੂੰ ਮੁਨਾਫ਼ਾ ਬਹੁਤ ਵਧੀਆ ਹੁੰਦਾ ਹੈ ਫਿਰ ਜਿਸ ਨਾਲ ਕਿ ਅਸੀਂ ਭੁ ਇਹਦਾ ਭਰਪੂਰ ਭਰਪੂਰ ਫ਼ਾਇਦਾ ਚੁੱਕ ਸਕਦੇ ਹਾਂ ਤਾਂ ਅਤੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਯੂਜ ਕਰਕੇ ਇਸਦਾ ਲ ਲਾਭ ਲਾਭ ਲਈਏ ਜਿਸ ਨਾਲ ਕਿ ਅਸੀਂ ਇਸ ਨੂੰ ਅੱਛੇ ਡਿਸਕਾਊਂਟ 'ਤੇ ਪੂਰਾ ਪ੍ਰੋਫਿਟ ਚੁੱਕ ਸਕੀਏ